ਜਿਹੜਾ ਇਤਿਹਾਸਕ ਜਿਹੜਾ ਮੈਨੂੰ ਪਤਾ ਹੈ ਕਿ ਫਤਹਿਗੜ੍ਹ ਸਾਹਿਬ ਦੇ ਵਿੱਚ ਜਿਹੜੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਸਨ ਛੋਟੇ ਸਪੁੱਤਰ ਜੋ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਉਨ੍ਹਾਂ ਨੂੰ ਕੰਧਾਂ ਦੇ ਵਿੱਚ ਚਿਣ ਦਿੱਤਾ ਗਿਆ ਸੀਗਾ ਕਿਉਂਕਿ ਉਹ ਚਾ ਉਨ੍ਹਾਂ ਤੋਂ ਜਿਹੜੇ ਮੁਸਲਮਾਨ ਸੀਗੇ ਉਹ ਕਹਿੰਦੇ ਸੀਗੇ ਕਿ ਤੁਸੀਂ ਸਾਡਾ ਜਿਹੜਾ ਧਰਮ ਹੈ ਉਹਨੂੰ ਕਬੂਲ ਕਰੋ ਆਪਣੀ ਸਿੱਖੀ ਨੂੰ ਛੱਡ ਦਿਉ ਪਰ ਉਨ੍ਹਾਂ ਨੇ ਬੱਚਿਆਂ ਨੇ ਆਪਣੀ ਸਿੱਖੀ ਨੂੰ ਮਤਲਬ ਕਿ ਉਨ੍ਹਾਂ ਨੂੰ ਕਿਹਾ ਕਿ ਅਸੀਂ ਆਪਣੀ ਸਿੱਖੀ ਨਹੀਂ ਛੱਡਾਂਗੇ ਨਾ ਹੀ ਅਸੀਂ ਤੁਹਾਡਾ ਧਰਮ ਅਪਣਾਵਾਂਗੇ ਇਸ ਕਰਕੇ ਉਹ ਉਨ੍ਹਾਂ ਦੇ ਖਿਲਾਫ ਗਏ ਅਤੇ ਜਦੋਂ ਉਨ੍ਹਾਂ ਨੂੰ ਮੁਸਲਮਾਨ ਨੂੰ ਔਰੰਗਜ਼ੇਬ ਨੂੰ ਪਤਾ ਚੱਲਿਆ ਕਿ ਇਹ ਸਾਡਾ ਧਰਮ ਨਹੀਂ ਅਪਣਾ ਰਹੇ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਸਜ਼ਾ ਦਿੱਤੀ ਕਿ ਨਾ ਛੋਟੇ ਸਾਹਿਬਜ਼ਾਦਿਆਂ ਨੂੰ ਦੋਨਾਂ ਨੂੰ ਕੰਧਾਂ ਵਿੱਚ ਚਿਣ ਦਿੱਤਾ ਜਾਵੇ ਜਦੋਂ ਕਿ ਉਨ੍ਹਾਂ ਦੀ ਉਮਰ ਇੱਕ ਦੀ ਗਿਆਰ੍ਹਾਂ ਸਾਲ ਅਤੇ ਨੌ ਸਾਲ ਦੀ ਸੀ ਔਰ ਇਹ ਬਹੁਤ ਜ਼ਿਆਦਾ ਦੁੱਖ ਭਰੀ ਵਾਲ਼ੀ ਖਬਰ ਸੀਗੀ ਜਦੋਂ ਸਾਰਿਆਂ ਨੂੰ ਪਤਾ ਚੱਲਿਆ ਅਤੇ ਇਸ ਤੋਂ ਬਾਅਦ ਜਦੋਂ ਬੱਚਿਆਂ ਨੂੰ ਉਨ੍ਹਾਂ ਦੇ ਕੰਧਾਂ ਦੇ ਵਿੱਚ ਚਿਣ ਦਿੱਤਾ ਗਿਆ ਉਹ ਉਨ੍ਹਾਂ ਦੇ ਉੱਥੇ ਹੀ ਸਾਹ ਖਤਮ ਹੋ ਗਏ ਸਨ ਅਤੇ ਅੱਜ ਵੀ ਉਹ ਉਸ ਥਾਂ ਦੇ ਉੱਤੇ ਗੁਰਦੁਆਰਾ ਸਾਹਿਬ ਸਥਾਪਿਤ ਹੈ ਜਿਸ ਦਾ ਨਾਮ ਹੈ ਫਤਹਿਗੜ੍ਹ ਸਾਹਿਬ ਦੇ ਵਿੱਚ ਸਥਾਪਿਤ ਹੈ ਅਤੇ ਸਾਰੇ ਦੂਰ ਦੂਰ ਤੋਂ ਲੋਕ ਉੱਥੇ ਦਰਸ਼ਨ ਕਰਨ ਆਉਂਦੇ ਹਨ